ਛੱਬੀ ਜਨਵਰੀ ਉੱਨੀ ਸੌ ਵੀਹ ਪੰਦਰ੍ਹਾਂ ਅਗਸਤ ਦੋ ਹਜ਼ਾਰ ਤਿੰਨ ਇੱਕ ਜੁਲਾਈ ਦੋ ਹਜ਼ਾਰ ਤੇਰ੍ਹਾਂ ਦੋ ਅਕਤੂਬਰ ਦੋ ਹਜ਼ਾਰ ਵੀਹ ਅਠਾਰ੍ਹਾਂ ਅਪ੍ਰੈਲ ਉੱਨੀ ਸੌ ਤਰਾਨਵੇਂ